ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਸਪੋਰਟਸ ਟੀਚਰ ਬੋਲ ਰਹੇ ਹੋ ਮੈਮ ਮੈਂ ਨਾ ਸਪੋਰਟਸ ਦੇ ਵਿੱਚ ਆਓ ਜੁਆਇਨ ਕਰਨਾ ਸੀਗਾ ਅਤੇ ਤੁਸੀਂ ਦੱਸ ਸਕਦੇ ਵੀ ਤੁਸੀਂ ਕਿਹੜੀਆਂ ਕਿਹੜੀਆਂ ਗੇਮਾਂ ਕਰਵਾਉਂਦੇ ਹੋ ਮੈਮ ਅਸੀਂ ਭਾਈਕੇ ਤੋਂ ਬੋਲ ਰਹੇ ਹਾਂ ਹਾਂਜੀ ਮੈਮ ਠੀਕ ਹੈ ਹਾਂਜੀ ਮੈਮ ਮੈਮ ਡਾਂਸ ਕਰਾਟੇ ਦੇ ਬੈਨੀਫਿਟ ਕੀ ਹੁੰਦੇ ਆ ਇਹਦੇ 'ਚ ਕੋਈ ਰਿਸਕ ਤਾਂ ਨਹੀਂ ਹੁੰਦਾ ਗਾ ਹਾਂਜੀ ਹਾਂਜੀ ਮੈਮ ਓਕੇ ਮੈਮ ਮੈਮ ਫਿਰ ਤਾਂ ਮੈਂ ਜੇ ਕੋਈ ਇਹਦੇ ਵਿੱਚ ਰਿਸਕ ਨਹੀਂ ਹੈਗਾ ਗਾ ਫਿਰ ਤਾਂ ਮੈਂ ਆਪਣੇ ਫਰੈਂਡਸ ਨੂੰ ਵੀ ਕਹਿ ਦੂੰਗੀ ਉਹ ਵੀ ਆ ਜਿਆ ਕਰਨਗੀਆਂ ਹਾਂਜੀ ਮੈਮ ਪਹਿਲਾਂ ਮੈਮ ਮੈਂ ਵੋਲੀਬਾਲ ਖੇਡਦੀ ਹੁੰਦੀ ਸੀਗੀ ਅਤੇ ਹੁਣ ਛੁੱਟੀਆਂ ਹੋ ਰਹੀਆਂ ਸੀਗੀਆਂ ਤਾਂ ਕਰਕੇ ਫਿਰ ਮੇਰੀ ਇੱਕ ਸਟੱਡੀ ਤਾਂ ਕੰਪਲੀਟ ਹੋ ਗਈ ਤਾਂ ਕਰਕੇ ਫਿਰ ਮੈਂ ਸੋਚਿਆ ਚਲੋ ਮੈਂ ਕਿਸੇ ਗੇਮ ਦੇ ਵਿੱਚ ਆ ਜਾਂ ਅਤੇ ਮੈਂ ਤਾਂ ਕਰਕੇ ਫਿਰ ਮੈਨੂੰ ਤੁਹਾਡਾ ਨੰਬਰ ਮਿਲਿਆ ਅਤੇ ਮੈਂ ਤਾਂ ਕਰਕੇ ਫਿਰ ਤੁਹਾਨੂੰ ਕਾਲ ਕੀਤੀ ਸੀਗੀ ਹਾਂਜੀ ਮੈਮ ਅਤੇ ਹਾਂਜੀ ਮੈਮ ਮੈਂ ਜੁਆਇਨ ਕਰਨਾ ਚਾਹੁੰਦੀ ਹਾਂ ਅਤੇ ਇਹਦੀ ਕੋਈ ਮੈਮ ਫੀਸ ਤਾਂ ਨਹੀਂ ਹੈਗੀ ਜੀ ਹਾਂਜੀ ਮੈਮ ਓਕੇ ਮੈਮ ਹਾਂਜੀ ਓਕੇ ਮੈਮ ਮੈਮ ਓਕੇ ਮੈਮ ਮੈਮ ਕੋਈ ਹੋਰ ਗੇਮ ਨਹੀਂ ਕਰਵਾਉਂਦੇ ਹੈਗੇ ਤੁਸੀਂ ਓਕੇ ਮੈਮ ਓਕੇ ਮੈਮ ਹਾਂਜੀ ਕੋਈ ਗੱਲ ਨਹੀਂ ਮੈਮ ਮੈਮ ਫਿਰ ਮੇਰਾ ਨੇਮ ਲਿਖ ਲਿਓ ਮੇਰਾ ਨਾਮ ਬਲਜੀਤ ਕੌਰ ਹੈ ਹਾਂਜੀ ਹਾਂਜੀ ਮੈਮ ਅਤੇ ਮੇਰੀ ਏਜ ਮੈਮ ਟਵੰਟੀ ਟਵੈਂਟੀ ਇਅਰ ਹੈ ਹਾਂਜੀ ਮੈਮ ਮੈਮ ਕੋਈ ਡਰੈਸ ਵਗੈਰਾ ਹੈਗੀ ਇਹਦੀ ਹਾਂਜੀ ਓਕੇ ਮੈਮ ਮੈਂਮ ਮੈਂ ਆਪਣੇ ਫਰੈਂਡਸ ਨੂੰ ਫਿਰ ਕਹਿ ਦੂੰਗੀ ਵੀ ਉਹ ਜੁਆਇਨ ਕਰ ਲੈਣਗੀਆਂ ਅਤੇ ਹਾਂਜੀ ਹਾਂਜੀ ਮੈਮ ਹਾਂਜੀ ਚਲੋ ਠੀਕ ਹੈ ਮੈਮ ਬਾਏ ਫਿਰ ਥੈਂਕ ਯੂ ਮੈਮ